ਹੈਲ ਨਮਸ਼ਕਾਰ ਜੀ ਅੰਕਿਤ ਦੇ ਫਾਦਰ ਬੋਲ ਰਹੇ ਹੋ ਮੈਂ ਆਨੰਦ ਸਕੂਲ ਤੋਂ ਬੋਲ ਰਿਹਾਂ ਜੀ ਟੀਚਰ ਬੋਲ ਰਿਹਾਂ ਅਸੀਂ ਨਾ ਇੱਕ ਦਸਵੀਂ ਦੇ ਬੱਚੇ ਸਕੂਲ ਦੇ ਬੱਚੇ ਜਿਹੜੇ ਹੈਗੇ ਆ ਸਕੂਲ ਦਾ ਇੱਕ ਟ੍ਰਿਪ ਲੈ ਕੇ ਜਾ ਰਹੇ ਦਸਵੀਂ ਦੇ ਬੱਚਿਆਂ ਵਾਸਤੇ ਅਤੇ ਅਸੀਂ ਬੱਚਿਆਂ ਦੇ ਪੇਰੈਂਟਸ ਨੂੰ ਫ਼ੋਨ ਕਰਕੇ ਉਹਨਾਂ ਦੀ ਕਨਸੈਂਟ ਲੈਣਾ ਚਾਹ ਰਹੇ ਹਾਂ ਕਿ ਉਹ ਬੱਚਿਆਂ ਨੂੰ ਸਾਡੇ ਨਾਲ ਟ੍ਰਿਪ 'ਤੇ ਭੇਜਣ ਲਈ ਅਲਾਓ ਕਰ ਦੇਣਗੇ ਅਤੇ ਜੀ ਸਾਡਾ ਜਿਹੜਾ ਟ੍ਰਿਪ ਹੈਗਾ ਵਾ ਉਹ ਟ੍ਰਿਪ ਹੋਏਗਾ ਦੋ ਦਿਨ ਦਾ ਟ੍ਰਿਪ ਹੋਏਗਾ ਠੀਕ ਆ ਜੀ ਇੱਕ ਤਾਂ ਨਾਈਟ ਅਤੇ ਦੋ ਡੇਜ਼ ਇਹ ਜਾਣਾ ਸਾਡਾ ਅਨੰਦਪੁਰ ਸਾਹਿਬ ਵੱਲ ਜਾਏਗਾ ਅਨੰਦਪੁਰ ਸਾਹਿਬ ਉੱਥੇ ਸਾਡੇ ਜਿਹੜੇ ਵੀ ਬੱਚੇ ਹੋਣਗੇ ਉੱਥੇ ਉਹਨਾਂ ਨੂੰ ਲਿਜਾਣ ਲਈ ਉਹਨਾਂ ਦਾ ਰਹਿਣ ਸਹਿਣ ਦਾ ਜੋ ਵੀ ਸਾਰਾ ਖਰਚਾ ਹੋਏਗਾ ਉਹ ਸਕੂਲ ਕਰੇਗੀ ਅਤੇ ਉਹਦੇ ਲਈ ਤੁਹਾਨੂੰ ਜਿਹੜਾ ਹੈਗਾ ਵਾ ਜਿਹੜਾ ਦੋ ਹਜ਼ਾਰ ਰੁਪਇਆ ਪਰ ਬੱਚਾ ਜਿਹੜਾ ਆਪਾਂ ਚਾਰਜਿਸ ਲੈ ਰਹੇ ਹਾਂ ਠੀਕ ਆ ਜੀ ਅਤੇ ਤੁਹਾਡੇ ਕੋਲੋਂ ਬਸ ਇਹੀ ਜਾਣਕਾਰੀ ਲੈਣੀ ਕਿ ਤੁਸੀਂ ਬੱਚੇ ਨੂੰ ਅਲਾਓ ਕਰੋਗੇ ਭੇਜਣ ਵਾਸਤੇ ਜੀ ਸਾਡਾ ਨਾ ਇੱਕ ਕਨਸੈਂਟ ਫਾਰਮ ਅਸੀਂ ਅੱਜ ਬੱਚਿਆਂ ਨੂੰ ਦੇ ਰਹੇ ਹਾਂ ਉਹ ਕਨਸੈਂਟ ਫਾਰਮ ਜਿਹੜਾ ਹੈਗਾ ਵਾ ਤੁਸੀਂ ਉੱਥੇ ਆਪਣੇ ਸਾਈਨ ਕਰਕੇ ਅਤੇ ਬੱਚਿਆਂ ਨੂੰ ਲਿਖ ਕੇ ਭੇਜ ਦੇਣਾ ਕਿ ਅਲਾਓ ਕਰ ਦੇ ਹੋ ਅਤੇ ਅਸੀਂ ਉਹ ਜਿਹੜਾ ਹੈਗਾ ਤੁਹਾਨੂੰ ਫੇਰ ਬੱਚੇ ਨੂੰ ਲੈ ਜਾਵਾਂਗੇ ਠੀਕ ਹੈ ਜੀ ਜੀ ਜੀ ਜੀ ਜੀ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ